ਸਤਿ ਸ਼੍ਰੀ ਅਕਾਲ ਸਰ ਮੈਂ ਗਗਨਪ੍ਰੀਤ ਕੌਰ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਮੈਂ ਤੁਹਾਡੇ ਕੱਲ੍ਹ ਪਰਸੋਂ ਮੈਂ ਕੈਬ ਬੁੱਕ ਕਰਵਾਈ ਸੀ ਜਿਸ ਵਿੱਚ ਮੈਂ ਕੋਵਿਡ ਕਰਕੇ ਮੇਰੇ ਪੇਪਰ ਸੀ ਅਤੇ ਮੈਂ ਕੋਵਿਡ ਕਰਕੇ ਕੈਬ ਬੁਕ ਕਰਵਾਈ ਸੀ ਅਤੇ ਮੈਂ ਉਹਦੇ ਵਿੱਚ ਸਾਫ਼ ਮੈਨਸ਼ਨ ਕੀਤਾ ਸੀ ਕਿ ਕੋਵਿਡ ਦਾ ਸਮਾਂ ਚੱਲ ਰਿਹਾ ਹੈ ਅਤੇ ਜਿਹੜਾ ਡਰਾਈਵਰ ਹੋਵੇਗਾ ਉਹ ਮਾਸਕ ਵਗੈਰਾ ਪਾ ਕੇ ਰੱਖੇਗਾ ਅਤੇ ਸਾਇਨੀਟਾਈਜ਼ਰ ਵਗੈਰਾ ਯੂਜ ਕਰੇਗਾ ਅਤੇ ਕਾਰ ਦੀ ਸਫ਼ਾਈ ਹੋਣੀ ਚਾਹੀਦੀ ਆ ਪਰ ਜਦੋਂ ਮੈਂ ਉੱਥੇ ਪੇਪਰ ਮੇਰਾ ਪੇਪਰ ਸੀ ਕੋਈ ਨਿੱਜੀ ਪੇਪਰ ਸੀ ਇਸ ਕਰਕੇ ਮੈਂ ਜਦੋਂ ਪਠਾਰਕੋਟ ਤੋਂ ਅੰਮ੍ਰਿਤਸਰ ਲਈ ਬੁਕਿੰਗ ਕਰਵਾਈ ਸੀ ਡਰਾਈਵਰ ਦੀ ਕੈਬ ਦੀ ਤਾਂ ਮੈਂ ਆਹ ਦੇਖ ਕੇ ਬਹੁਤ ਹੈਰਾਨ ਹੋ ਗਈ ਕਿ ਜਿਹੜਾ ਡਰਾਈਵਰ ਸੀ ਉਸਨੇ ਮਾਸਕ ਵੀ ਨਹੀਂ ਪਾਇਆ ਅਤੇ ਮਤਲਬ ਸੈਨੀਟਾਇਜਰ ਵੀ ਨਹੀਂ ਕੀਤਾ ਅਤੇ ਮੈਂ ਉਹਨੂੰ ਕਿਹਾ ਸੀ ਕਿ ਉਹ ਸੈਨੀਟਾਇਜਰ ਅਤੇ ਮਾਸਕ ਪਾਵੇ ਤਾਂ ਉਸ ਨੇ ਸਾਫ਼ ਮਨਾ ਕਰਤਾ ਕਿਉਂਕਿ ਉਸ ਕੋਲ ਮਾਸਕ ਵੀ ਨਹੀਂ ਸੀ ਅਤੇ ਸੈਨੀਟਾਇਜ਼ਰ ਵੀ ਨਹੀਂ ਅਤੇ ਮੈਂ ਇਹ ਦੇਖ ਕੇ ਬਹੁਤ ਨਿਰਾਸ਼ ਹੋ ਗਈ ਅਤੇ ਮੈਂ ਜਦੋਂ ਉਹਨੂੰ ਕਿਹਾ ਤਾਂ ਉਹਨੇ ਸਾਫ਼ ਹੀ ਮਨਾ ਕਰਤਾ ਸੀ ਅਤੇ ਫਿਰ ਮੈਂ ਇਹ ਵੀ ਦੇਖਿਆ ਕਿ ਕਾਰ ਵੀ ਗੰਦੀ ਸੀ ਅਤੇ ਸੀਟਾਂ ਵੀ ਬਹੁਤ ਜ਼ਿਆਦਾ ਗੰਦੀਆਂ ਸੀ ਅਤੇ ਮੈਂ ਆਪਣੀ ਜਾਨ ਦਾ ਜੋਖਿਮ ਲੈ ਕੇ ਕੋਵਿਡ ਦੇ ਸਮੇਂ ਵਿੱਚ ਉਹ ਕਾਰ 'ਚ ਬੈਠੀ ਕਿਉਂਕਿ ਮੇਰਾ ਪੇਪਰ ਸੀ ਅਤੇ ਮੇਰਾ ਜਾਣਾ ਜ਼ਰੂਰੀ ਸੀ ਅਤੇ ਮੈਂ ਉਸ ਕਾਰ ਵਿੱਚ ਬਹਿ ਗਈ ਅਤੇ ਮੈਨੂੰ ਆਪਣੀ ਜਾਨ ਦਾ ਰਿਸਕ ਅਤੇ ਮੈਂ ਆਹ ਕੱਲ੍ਹ ਪਰਸੋਂ ਹੀ ਉਹ ਬੁੱਕ ਕਰਵਾਈ ਸੀ ਅਤੇ ਮੈਂ ਉਹਨੂੰ ਤਿੰਨ ਹਜ਼ਾਰ ਰੁਪਇਆ ਦਿਤਾ ਸੀ ਕੈਬ ਦਾ ਮੈਂ ਇੰਨੀ ਮਹਿੰਗੀ ਕੈਬ ਕਰਵਾਈ ਕਿ ਉਹ ਆਪਣੀ ਜਾਣ ਦੇ ਕਰਕੇ ਅਤੇ ਇਸ ਕਰਕੇ ਇਸ ਕਰਕੇ ਮੈਂ ਜੋ ਸਰਵਿਸ ਆ ਉਹ ਠੀਕ ਤਰੀਕੇ ਨਾਲ ਨਹੀਂ ਹੋਈ ਇਸ ਕਰਕੇ ਮੈਨੂੰ ਥੋੜ੍ਹਾ ਰਿਫੰਡ ਵਾਪਿਸ ਕੀਤਾ ਜਾਵੇ ਧੰਨਵਾਦ